ਹੈਲੋ ਹਾਂਜੀ ਭਾਅ ਜੀ ਹਾਂਜੀ ਭਾਅ ਜੀ ਜ਼ਰੂਰ ਹਾਂਜੀ ਆਪਣੇ ਮਤਲਬ ਕਿ ਜਿਹੜੀ ਸਿੱਖ ਧਰਮ ਦੀ ਸਥਾਪਨਾ ਹੈ ਉਹ ਸਾਢੇ ਪੰਜ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਉਹਨਾਂ ਨੇ ਆਪਾਂ ਨੂੰ ਨਾਮ ਜਪੋ ਕਿਰਤ ਕਰੋ ਵੰਡ ਛਕੋ ਦਾ ਸੰਦੇਸ਼ ਦਿੱਤਾ ਸੀਗਾ ਸਾਰੇ ਰਲ ਮਿਲ ਕੇ ਰਹਿਣ ਹੱਕ ਦੀ ਕਮਾਈ ਖਾਣ ਉਹਨਾਂ ਨੇ ਸੱਚਾ ਸੌਦਾ ਸ਼ੁਰੂ ਕੀਤਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਮਤਲਬ ਕਿ ਆਪਣੀ ਉਹਨਾਂ ਨੇ ਅੰਮ੍ਰਿਤ ਛਕਾਇਆ ਸੀ ਉਹਨਾਂ ਨੇ ਮਤਲਬ ਕਿਹਾ ਸਾਰੇ ਸਿੱਖ ਸਿੰਘ ਜਿਹੜੇ ਉਹ ਸਿੱਖ ਬਣ ਕੇ ਰਹਿਣ ਹਾਂਜੀ ਗੁਰੂ ਰਾਮਦਾਸ ਆਪਣੇ ਅੰਮ੍ਰਿਤਸਰ ਦੇ ਜਿੱਦਾਂ ਕਿ ਹਰਿਮੰਦਰ ਸਾਹਿਬ ਦੂਰੋਂ ਦੂਰੋਂ ਸੰਗਤ ਆਉਂਦੀ ਆ ਅਤੇ ਧਾਰਮਿਕ ਸਥਾਨ ਹੈ ਹੋਰ ਵੀ ਬੜੇ ਗੋਬਿੰਦਵਾਲ ਸਾਹਿਬ ਖਡੂਰ ਸਾਹਿਬ ਵੱਖ ਵੱਖ ਧਾਰਮਿਕ ਸਥਾਨ ਆ ਆਪਣੇ ਇੱਥੇ ਹਾਂਜੀ ਅਤੇ ਇੱਥੇ ਸੰਗਤ ਆਉਂਦੀ ਆ ਆਪਣੇ ਦਰਸ਼ਨ ਕਰਦੀ ਆ ਗੁਰੂ ਤੇਗ ਬਹਾਦਰ ਜੀ ਨੇ ਆਪਾਂ ਨੂੰ ਜਿਹੜੇ ਆ ਵੀ ਤੁਹਾਨੂੰ ਪਤਾ ਹੀ ਆ ਵੀ ਮੁਗਲਾਂ ਦੇ ਨਾਲ ਲੜਾਈਆਂ ਹੁੰਦੀਆਂ ਰਹੀਆਂ ਸੀ ਅਤੇ ਆਪਣਾ ਸਾਰਾ ਸਿੱਖ ਧਰਮ ਨੂੰ ਬਚਾਉਣ ਦੇ ਲਈ ਆਪਣਾ ਜਿਹੜਾ ਸਾਰਾ ਪਰਿਵਾਰ ਹੀ ਉਹ ਵਾਰਤਾ ਸੀਗਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਤੁਹਾਨੂੰ ਪਤਾ ਚਾਰ ਸਾਹਿਬਜ਼ਾਦੇ ਸੀ ਉਹਨਾਂ ਚੌਹਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ ਸਿੱਖੀ ਨੂੰ ਬਚਾਉਣ ਵਾਸਤੇ ਠੀਕ ਹੈ ਭਾਅ ਜੀ ਹਾਂਜੀ ਠੀਕ ਹੈ ਭਾਅ ਜੀ